ਸਿਲਾਈ ਵਿੱਚ ਮਹੱਤਵਪੂਰਨ ਚੀਜ਼ਾਂ ਹਨ ਜਿਵੇਂ ਕਿ ਇੰਚੀ ਟੇਪ ਅਤੇ ਕੈਂਚੀ ਅਤੇ ਮਸ਼ੀਨ ਮਸ਼ੀਨ ਦਾ ਤੇਲ ਅਤੇ ਫਿਰਕੀ ਡੱਬੀ ਇਹ ਸਾਰੀਆਂ ਬਹੁਤ ਮਹੱਤਵਪੂਰਨ ਚੀਜ਼ਾਂ ਹਨ ਇਸ ਤੋਂ ਇਲਾਵਾ ਇੱਕ ਫੁੱਟਾ ਜਾਂ ਸਕੇਲ ਵੀ ਰੱਖਿਆ ਜਾਂਦਾ ਹੈ ਸਕੇਲ ਨੂੰ ਪਜਾਮਾ ਬਣਾਉਣ ਲਈ ਨਾਪਣ ਲਈ ਰੱਖਿਆ ਜਾਂਦਾ ਹੈ ਇਹਨਾਂ ਦੇ ਵਿੱਚੋਂ ਇੱਕ ਕਮੀਜ਼ ਦੇ ਕੱਪੜੇ ਜਾਂ ਕਿਸੇ ਵੀ ਚੀਜ਼ ਦਾ ਕੱਪੜਾ ਸਿਲਕ ਕੋਟਨ ਜਾਂ ਕੋਈ ਵੀ ਕੱਪੜਾ ਲਿਆ ਜਾਂਦਾ ਹੈ ਜਾਂ ਅਖਬਾਰਾਂ ਲਈਆਂ ਜਾਂਦੀਆਂ ਹਨ ਜਿਸ ਵਿੱਚ ਕਟਿੰਗ ਲਈ ਆਸਾਨੀ ਹੋ ਜਾਂਦੀ ਹੈ ਅਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਹੈ ਫਿਲਹਾਲ ਤਾਂ ਮੈਂ ਹੁਣ ਨਿਊ ਨਿਊ ਕਟਿੰਗ ਸਿੱਖ ਰਹੀ ਹਾਂ ਅਤੇ ਮੈਂ ਇਸ ਵਿੱਚ ਅਖਬਾਰਾਂ ਅਤੇ ਕੱਪੜੇ ਦੀ ਵੀ ਬਹੁਤ ਜ਼ਰੂਰਤ ਪੈਂਦੀ ਹੈ ਇਸ ਕਰਕੇ ਇਸ ਵਿੱਚ ਇੰਚੀ ਟੇਪ ਡੱਬੀ ਸੂਈਆਂ ਤਰਪਾਈ ਕਰਨ ਲਈ ਸੂਈਆਂ ਦੀ ਵੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਛੋਟੀ ਸੂਈਆਂ ਜਾਂ ਵੱਡੀਆਂ ਸੂਈਆਂ ਸੂਆ ਅਤੇ ਜੇ ਕੋਈ ਸਿਲਾਈ ਉਧੇੜਨੀ ਹੋਵੇ ਤਾਂ ਵੀ ਵੱਡੇ ਸੂਏ ਦੀ ਜ਼ਰੂਰਤ ਪੈਂਦੀ ਹੈ ਧੰਨਵਾਦ